ਹੈਲੋ ਸਤਿ ਸ਼੍ਰੀ ਅਕਾਲ ਜੀ ਫਲਿੱਪਕਾਰਟ ਤੋਂ ਗੱਲ ਕਰਦੇ ਹੋ ਮੈਂ ਤੁਹਾਡੀ ਸਾਈਟ ਤੋਂ ਇੱਕ ਤੇਰ੍ਹਾਂ ਪ੍ਰੋ ਮੈਕਸ ਫੋਨ ਆਰਡਰ ਕੀਤਾ ਸੀ ਜੋ ਕਿ ਮੈਨੂੰ ਡਿਲੀਵਰੀ ਬੋਏ ਨੇ ਬਹੁਤ ਵਧੀਆ ਤਰੀਕੇ ਨਾਲ ਅਤੇ ਬਹੁਤ ਵਧੀਆ ਬਿਹੇਵ ਨਾਲ ਮੇਰੇ ਕੋਲ ਆਇਆ ਅਤੇ ਮੈਨੂੰ ਉਹਨੇ ਪਾਰਸਲ ਰਿਸੀਵ ਕਰਵਾਇਆ ਜਿਸ ਦੀ ਪੈਕਿੰਗ ਬਹੁਤ ਹੀ ਜ਼ਿਆਦਾ ਵਧੀਆ ਸੀ ਅਤੇ ਅਤੇ ਡਿਲੀਵਰੀ ਬੋਏ ਨੇ ਵੀ ਮੇਰੇ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਜਦੋਂ ਕਿ ਉਸਨੇ ਮੇਰੀ ਬਹੁਤ ਟਾਈਮ ਕੁਛ ਸਮੇਂ ਤੱਕ ਦੀ ਮੇਰੀ ਵੇਟ ਵੀ ਕੀਤੀ ਕਿਉਂਕਿ ਮੇਰੇ ਕੋਲ ਆਧਾਰ ਕਾਰਡ ਦੀ ਫੋਟੋਕੋਪੀ ਨਹੀਂ ਸੀ ਅਤੇ ਮੈਂ ਫੋਟੋਕੋਪੀ ਮਾਰਕਿਟ ਤੋਂ ਕਰਵਾ ਕੇ ਉਸਨੂੰ ਦਿੱਤੀ ਅਤੇ ਉਸ ਦਾ ਟਾਈਮ ਵੀ ਖਰਾਬ ਹੋਇਆ ਪਰ ਉਸਨੇ ਫਿਰ ਵੀ ਮੇਰੇ ਨਾਲ ਬਹੁਤ ਵਧੀਆ ਬਿਹੇਵ ਕੀਤਾ ਅਤੇ ਜਦੋਂ ਮੈਂ ਆਪਣੇ ਬਾਕਸ ਨੂੰ ਖੋਲ੍ਹਿਆ ਤਾਂ ਇਸ ਦੀ ਪੈਕਿੰਗ ਬਹੁਤ ਹੀ ਜ਼ਿਆਦਾ ਵਧੀਆ ਸੀ ਫੋਨ ਦੀ ਕੋਈ ਵੀ ਡੈਮੇਜ ਪ੍ਰੋਬਲਮ ਆਉਣ ਦਾ ਕੋਈ ਚਾਂਸ ਨਹੀਂ ਸੀ ਅਤੇ ਜਦੋਂ ਮੈਂ ਇਸ ਨੂੰ ਔਨ ਕੀਤਾ ਤਾਂ ਇਸ ਦੀ ਮੈਟਲ ਦੀ ਬੋਡੀ ਬਹੁਤ ਹੀ ਜ਼ਿਆਦਾ ਵਧੀਆ ਸੀ ਅਤੇ ਇਸ ਦੀ ਇਸ ਦਾ ਰੰਗ ਕਾਲਾ ਸਾਰਿਆਂ ਨਾਲੋਂ ਜ਼ਿਆਦਾ ਜੱਚ ਰਿਹਾ ਸੀ ਅਤੇ ਜਦੋਂ ਮੈਂ ਇਸਨੂੰ ਔਨ ਕੀਤਾ ਤਾਂ ਇਸਦੀ ਡਿਸਪਲੇ ਬਹੁਤ ਜ਼ਿਆਦਾ ਵਧੀਆ ਸੀ ਅਤੇ ਇਹ ਫੁੱਲ ਐੱਚ ਡੀ ਅਤੇ ਫੋਰ ਕੇ ਤੱਕ ਵੀ ਮੈਂ ਇਸ 'ਤੇ ਵੀਡੀਉ ਦੇਖ ਸਕਦਾ ਹਾਂ ਅਤੇ ਕੈਮਰਾ ਇਸ ਦੇ ਕੈਮਰੇ ਦਾ ਕੋਈ ਤੋੜ ਨਹੀਂ ਹੈ ਕਿਉਂਕਿ ਇਸਦਾ ਜ਼ੂਮਿੰਗ ਪੁਆਇੰਟ ਬਹੁਤ ਜ਼ਿਆਦਾ ਵਧੀਆ ਹੈ ਅਤੇ ਇਹ ਬਹੁਤ ਵਧੀਆ ਪਿਕਸਲ ਦੀਆਂ ਫੋਟੋਆਂ ਕਲਿੱਕ ਕਰਦਾ ਹੈ ਅਤੇ ਇਹ ਦਾ ਕੋਈ ਵੀ ਬਲਰ ਪੁਆਇੰਟ ਨਹੀਂ ਹੁੰਦਾ ਅਤੇ ਇਸ ਦੀ ਚਾਰਜਿੰਗ ਫਾਸਟ ਚਾਰਜਿੰਗ ਬਹੁਤ ਹੀ ਜ਼ਿਆਦਾ ਵਧੀਆ ਹੈ ਇਹ ਅੱਧੇ ਘੰਟੇ ਵਿੱਚ ਸਾਰਾ ਮੋਬਾਈਲ ਨੂੰ ਚਾਰਜ ਕਰ ਦਿੰਦਾ ਹੈ ਅਤੇ ਇਸਦੀ ਆਡੀਓ ਵੀ ਬਹੁਤ ਜ਼ਿਆਦਾ ਵਧੀਆ ਹੈ ਅਤੇ ਇਸ ਇਸ ਮੋਬਾਈਲ ਦਾ ਹੋਰ ਮੋਬਾਇਲਾਂ ਦੇ ਕੰਪੇਅਰ ਵਿੱਚ ਕੋਈ ਤੋੜ ਨਹੀਂ ਹੈ ਇਹ ਬਹੁਤ ਹੀ ਜ਼ਿਆਦਾ ਵਧੀਆ ਅਤੇ ਬਹੁਤ ਹੀ ਬੈਸਟ ਮੰਨਿਆ ਜਾ ਰਿਹਾ ਹੈ ਇਸ ਟਾਈਮ ਇਸ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਹੈ ਅਤੇ ਐਪ 'ਤੇ 'ਤੇ ਆਰਡਰ ਕਰਕੇ ਮੈਂ ਬਹੁਤ ਹੀ ਧੰਨਵਾਦੀ ਹਾਂ ਅਤੇ ਅੱਗੇ ਵੀ ਆਰਡਰ ਕਰਦਾ ਰਹਾਂਗਾ